ਜੇ ਅਸੀਂ ਬਿਜਲੀ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਰੋਜ਼ ਮਰ੍ਹਾ ਦੀ ਜ਼ਿੰਦਗੀ ਵਿੱਚ ਬਿਜਲੀ ਦਾ ਸਾਡੇ ਲਈ ਇੱਕ ਮਹੱਤਵਪੂਰਨ ਰੋਲ ਹੈ ਮੈਂ ਐਸਾ ਕਿਉਂ ਕਹਿ ਰਿਹਾ ਹਾਂ ਮੈਂ ਇੱਕ ਮਲਟੀਨੈਸ਼ਨਲ ਕੰਪਨੀ ਦਾ ਇਮਪਲੋਈ ਹਾਂ ਜੇ ਬਿਜਲੀ ਨਾ ਹੋਵੇ ਤਾਂ ਸਾਡੇ ਸਰਵਰ ਡਾਊਨ ਹੋ ਜਾਂਦੇ ਹਨ ਜਿਸ ਨਾਲ਼ ਖਾਸਾ ਨੁਕਸਾਨ ਹੁੰਦਾ ਹੈ ਮੈਂ ਇੱਕ ਕਸਟਮਰ ਸਰਵਿਸ ਕੰਪਨੀ 'ਚ ਹਾਂ ਜਿਸ ਨਾਲ ਕਨੈਕਟਿਵਿਟੀ ਜਾਣ ਨਾਲ਼ ਆਮ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਬਿਜਲੀ ਨਾ ਹੋਵੇ ਤਾਂ ਕਿਸਾਨਾਂ ਲਈ ਵੀ ਆਪਣੀ ਖੇਤੀ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ